ਗਾਇਕ ਵਰਗ ਵੱਲੋਂ ਸਾਡੇ ਸਮਾਜ ਨੂੰ ਬਹੁਤ ਪ੍ਰਭਾਵਿਤ ਕੀਤਾ ਜਾਂਦਾ ਹੈ ਆਮ ਲੋਕ ਗਾਇਕਾਂ ਨੂੰ ਆਪਣੇ ਜੀਵਨ ਦਾ ਮਾਡਲ ਮੰਨ ਕੇ ਉਹਨਾਂ ਦੇ ਵਿਚਾਰਾਂ ਨੂੰ ਅਪਣਾਉਣ ਦਾ ਯਤਨ ਕਰਦੇ ਹਨ ਇਸ ਲਈ ਗਾਇਕਾਂ ਦਾ ਇਹ ਫਰਜ ਬਣਦਾ ਹੈ ਕਿ ਉਹ ਸਮਾਜ ਨੂੰ ਸਿਰਜਣਾਤਮਕ ਬਣਾਉਣ ਲਈ ਵਧੀਆ ਗੀਤਕਾਰੀ ਅਪਣਾਉਣ ਉਹਨਾਂ ਵੱਲੋਂ ਲਏ ਗਏ ਗਲਤ ਗੀਤ ਸਮਾਜ ਵਿੱਚ ਨੂੰ ਬੜੇ ਨੀਵੇਂ ਪੱਧਰ ਵੱਲ ਲਿਜਾ ਸਕਦੇ ਹਾਂ ਆਮ ਦੇਖਿਆ ਗਿਆ ਹੈ ਕਿ ਉਹਨਾਂ ਵੱਲੋਂ ਗਾਏ ਗਏ ਗੀਤਾਂ ਦਾ ਲੋਕਾਂ ਉੱਤੇ ਬਹੁਤ ਪ੍ਰਭਾਵ ਪੈਂਦਾ ਹੈ ਜਿਵੇਂ ਜਿਵੇਂ ਕਿ ਲੋਕ ਗਲਤ ਗਲਤ ਪੱਧਰ ਵੱਲ ਚਲੇ ਜਾਂਦੇ ਹਨ ਇਹਨਾਂ ਵਿੱਚੋਂ ਚੰਗੇ ਗੀਤ ਗਾਉਣ ਵਾਲੇ ਜਿਵੇਂ ਸੁਭਦੀਪ ਸਿੱਧੂ ਮੂਸੇਵਾਲਾ ਗੁਰਦਾਸ ਮਾਨ ਦਲਜੀਤ ਦੋਸਾਂਝ ਚਮਕੀਲਾ ਬਿੰਦਰਖੀਆ ਆਦਿ ਹਨ